ਹਾਂ ਮੈਨੂੰ ਲਿਖਣ ਦਾ ਵੀ ਸ਼ੌਂਕ ਹੈ ਆਦਤ ਹੈ ਮੈਂ ਜਦੋਂ ਵੀ ਰੂਟੀਨ ਦੇ ਵਿੱਚ ਕੁਛ ਵੀ ਅ ਬਾਹਰ ਘੁੰਮਦਾ ਫਿਰਦਾ ਦੇਖਦਾ ਹਾਂ ਤਾਂ ਮੈਂ ਉਹ ਆਪਣੀਆਂ ਲਿਖਤਾਂ ਕਹਾਣੀਆਂ ਕਵਿਤਾਵਾਂ ਸ਼ੇਅਰਾਂ ਗੀਤਾਂ ਦੇ ਵਿੱਚ ਉਹਨਾਂ ਨੂੰ ਪਰੋਣ ਦੀ ਕੋਸ਼ਿਸ਼ ਕਰਦਾ ਹਾਂ ਉਸ ਦੇ ਨਾਲ ਦੇ ਨਾਲ ਰੂਟੀਨ ਦੇ ਵਿੱਚ ਵੀ ਮੈਂ ਆਪਣੀ ਡਾਇਰੀ ਵੀ ਲਿਖਦਾ ਹਾਂ ਅਤੇ ਉਹ ਮੈਂ ਜੋ ਵੀ ਕੰਮ ਕਰਨੇ ਹੁੰਦੇ ਹਨ ਜਾਂ ਇਹ ਕੀਤੇ ਜਾਂਦੇ ਹਨ ਉਹਨਾਂ ਨੂੰ ਡਾਇਰੀ ਦੇ ਵਿੱਚ ਮੈਨਟੇਨ ਕਰਕੇ ਰੱਖਦਾ ਹਾਂ ਉਸ ਤੋਂ ਇਲਾਵਾ ਵੀ ਮੈਂ ਆਪਣੇ ਗੀਤਾਂ ਕਵਿਤਾਵਾਂ ਦੇ ਵਿੱਚ ਜੋ ਦੇਖਿਆ ਹੁੰਦਾ ਜੋ ਅਨੁਭਵ ਕੀਤਾ ਹੁੰਦਾ ਉਹਨਾਂ ਨੂੰ ਪਰੋਣ ਦੀ ਕੋਸ਼ਿਸ਼ ਕਰਦਾ ਹਾਂ ਜਿਸ ਤਰ੍ਹਾਂ ਮੈਨੂੰ ਪੜ੍ਹਨ ਦਾ ਸ਼ੌਂਕ ਹੈ ਇਸ ਤਰਾਂ ਲਿਖਣ ਦਾ ਸ਼ੌਂਕ ਵੀ ਹੈ ਰੂਟੀਨ ਦੇ ਵਿੱਚ ਮੈਂ ਕੁਛ ਨਾ ਕੁਛ ਲਿਖਣ ਦੀ ਕੋਸ਼ਿਸ਼ ਵੀ ਕਰਦਾ ਹਾਂ ਕਿਉਂਕਿ ਮੈਂ ਪ੍ਰੋਫੈਸ਼ਨਲ ਤੌਰ 'ਤੇ ਵੀ ਲਿਖਦਾ ਹਾਂ ਇਸ ਕਰਕੇ ਰੂਟੀਨ ਦੇ ਵਿੱਚ ਜਦੋਂ ਵੀ ਮੈਨੂੰ ਸਮਾਂ ਮਿਲਦਾ ਇਕਾਂਤ ਵਿੱਚ ਬੈਠ ਕੇ ਮੈਂ ਕੁਛ ਨਾ ਕੁਛ ਜਿਹੜਾ ਉਹ ਲਿਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ